ਵੈਸੇ ਤਾਂ ਮੇਰੇ ਇਲਾਕੇ ਪਟਿਆਲੇ ਵਿੱਚ ਸਪੋਰਟਸ ਨੂੰ ਲੈ ਕੇ ਕਈ ਸਾਰੀਆਂ ਸੁਵਿਧਾਵਾਂ ਹਨ ਜਿਵੇਂ ਕਿ ਐੱਨ ਆਈ ਐੱਸ ਨੈਸ਼ਨਲ ਇੰਸਟੀਟਿਊਡ ਔਫ ਸਪੋਰਟਸ ਪੰਜਾਬੀ ਯੂਨੀਵਰਸਿਟੀ ਵੀ ਕਈ ਤਰ੍ਹਾਂ ਦੀਆਂ ਖੇਡਾਂ ਸਿਖਾਉਂਦੀ ਹੈ ਜਿਵੇਂ ਕੀ ਸਾਈਕਲਿੰਗ ਹੌਕੀ ਆਰਚਰੀ ਇਹਨਾਂ ਦੇ ਗਰਾਊਂਡ ਬਹੁਤ ਹੀ ਜ਼ਿਆਦਾ ਵਧੀਆ ਹਨ ਅਤੇ ਕੋਚਿਸ ਵੀ ਬਹੁਤ ਜ਼ਿਆਦਾ ਅੱਛੇ ਹਨ ਅਤੇ ਪਰ ਇੱਥੇ ਨੇਪੋਟਿਜ਼ਮ ਬਹੁਤ ਜ਼ਿਆਦਾ ਹੈ ਜਿਸ ਕਰਕੇ ਲੋਕ ਆਪਣੇ ਜਾਣਕਾਰਾਂ ਨੂੰ ਹੀ ਅੱਗੇ ਕਰਦੇ ਹਨ ਜਿਹੜੇ ਜਾਣ ਜ਼ਿਆਦਾ ਉੱਚੇ ਬੰਦੇ ਹੁੰਦੇ ਹਨ ਉਹਨਾਂ ਦੇ ਹੀ ਅੱਗੋਂ ਜਵਾਕਾਂ ਨੂੰ ਪਹਿਲ ਦਿੱਤੀ ਜਾਂਦੀ ਹੈ ਇਸ ਕਰਕੇ ਕਾਬਿਲ ਬੰਦੇ ਕਈ ਵਾਰ ਪਿੱਛੇ ਰਹਿ ਜਾਂਦੇ ਹਨ ਉਹਨਾਂ ਨੂੰ ਮੌਕਾ ਨਹੀਂ ਮਿਲ ਪਾਉਂਦਾ ਪਰ ਇਸ ਜਗ੍ਹਾ 'ਤੇ ਕਈ ਹੋਰ ਵੀ ਖੇਡਾਂ ਹਨ ਜਿਵੇਂ ਬੈਡਮਿੰਟਨ ਬਾਏ ਬੇਸਬੋਲ ਹੋ ਗਿਆ ਓਲੰਪਿਕ ਦੀਆਂ ਕਈ ਖੇਡਾਂ ਇਹਨਾਂ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ ਨਾ ਇਹਨਾਂ ਦੇ ਕੋਚਿਸ ਅੱਛੇ ਹਨ ਸਰਕਾਰਾਂ ਨੂੰ ਇਸ ਰਿਲੇਟਡ ਇੰਸਟੀਟਿਊਟ ਖੋਲਣੇ ਚਾਹੀਦੇ ਹਨ ਪਟਿਆਲੇ ਡਿਸਟ੍ਰਿਕਟ ਦੇ ਵਿੱਚ ਦੇਖਿਆ ਜਾਏ ਤਾਂ ਆਪ ਸਰਕਾਰ ਨੇ ਵੀ ਇੱਕ ਸਪੋਰਟਸ ਇੰਸਟੀਟਿਊਟ ਪਟਿਆਲਾ ਡਿਸਟ੍ਰਿਕਟ 'ਚ ਖੋਲਣ ਦੀ ਗੱਲ ਕੀਤੀ ਗਈ ਹੈ ਜਿੱਥੇ ਹੋਰ ਵੀ ਖੇਡਾਂ ਨੂੰ ਵਧਾਇਆ ਜਾਵੇਗਾ